ਪੰਜਾਬ ਦੀ ਸੰਸਕ੍ਰਿਤੀ ਪਹਿਲਾਂ ਨਾਲੋਂ ਬਹੁਤ ਅੱਛੀ ਹੋ ਗਈ ਹੈ ਅਤੇ ਹੁਣ ਜਿਵੇਂ ਪਹਿਲਾਂ ਪਿੰਡਾਂ ਵਿੱਚ ਅਨਪੜ੍ਹਤਾ ਜ਼ਿਆਦਾ ਤੀ ਸ਼ਹਿਰਾਂ ਵਿੱਚ ਹੈ ਸੀ ਹੁਣ ਸਾਰਾ ਕੁਛ ਬਰਾਬਰ ਹੋ ਗਿਆ ਪਿੰਡਾਂ ਦਾ ਵੀ ਅਤੇ ਸ਼ਹਿਰਾਂ ਦਾ ਵੀ ਪਿੰਡਾਂ ਵਿੱਚ ਵੀ ਉਵੇਂ ਹੀ ਪੜ੍ਹਾਈਆਂ ਕਰਦੇ ਬੱਚੇ ਅਤੇ ਉਵੇਂ ਹੀ ਨੌਕਰੀਆਂ ਵੀ ਸਭ ਕਰਦੇ ਹੈ ਅਤੇ ਰਹਿਣ ਸਹਿਣ ਵੀ ਪਿੰਡਾਂ ਦਾ ਵੀ ਸ਼ਹਿਰਾਂ ਵਰਗਾ ਹੋ ਗਿਆ ਪਹਿਲਾਂ ਅਲੱਗ ਸੀ ਬਹੁਤ ਜ਼ਿਆਦਾ ਪਿੰਡਾਂ ਵਾਲਿਆਂ ਦਾ ਅਲੱਗ ਹੁੰਦਾ ਸੀ ਅਤੇ ਸ਼ਹਿਰਾਂ ਦਾ ਅਲੱਗ ਹੁਣ ਸਾਰਾ ਪਿੰਡਾਂ ਵਾਲੇ ਵੀ ਸ਼ਹਿਰਾਂ ਵਾਂਗ ਰਹਿੰਦੇ ਹੈ ਸਭ ਸਾਫ਼ ਸੁਥਰੇ ਪਿੰਡਾਂ ਵਿੱਚ ਵਧੀਆ ਸਕੂਲ ਬਣੇ ਹੋਏ ਹੈ ਵਧੀਆ ਸਾਫ਼ ਸਫਾਈ ਵਧੀਆ ਰੱ ਰੱਖਦੇ ਹੈ